ਹੈਲੋ ਅਸੀਂ ਤਾ ਸਬਜ਼ੀ ਬਹੁਤ ਵਧੀਆ ਬਣਾ ਕੇ ਭੇਜੀ ਸੀ ਨਾ ਨਿਊਟਰੀ ਬਹੁਤ ਵਧੀਆ ਬਣੀ ਸੀਗੀ ਕਿਵੇਂ ਸੀ ਨਹੀਂ ਬਣੀ ਵਧੀਆ ਅਤੇ ਅਗਾਂਹ ਵਾਸਤੇ ਘੱਟ ਪਾ ਦਿਆ ਕਰਾਂਗੇ ਊਂ ਤਾਂ ਅਸੀਂ ਬਹੁਤ ਵਧੀਆ ਬਣਾਉਂਦੇ ਹਾਂ ਕੜ੍ਹੀ ਪੱਤਾ ਊਂ ਤਾਂ ਪਾਉਣੇ ਭੁੱਲ ਗਏ ਰਿਫੈਂਡ ਦੀ ਬਣਾਈ ਸੀਗੀ ਰਿਫੈਂਡ ਦੀ ਵਧੀਆ ਕੰਪਨੀ ਦਾ ਅਸੀਂ ਤਾਂ ਰਿਫੈਂਡ ਵੀ ਨਹੀਂ ਮਾੜਾ ਲਿਆਉਂਦੇ ਅੱਛਾ ਗਾਂ ਦੇ ਘਿਓ 'ਚ ਬਣਾਇਆ ਕਰੀਏ ਕਿ ਮੱਝ ਦੇ 'ਚ ਠੀਕ ਆ ਚਲੋ ਆਪਾਂ ਫਿਰ ਉਵੇਂ ਬਣਾ ਲਿਆ ਕਰਾਂਗੇ ਅਸੀਂ ਤਾਂ ਫਿਰ ਰਿਫਾਇੰਡ 'ਚ ਹੀ ਬਣਾਉਣੇ ਜਾਂ ਤੇਲ 'ਚ ਸਰੋਂ ਦੇ 'ਚ ਅੱਛਾ ਗੋਭੀ ਕੱਚੀ ਸੀਗੀ ਬਹੁਤੇ ਲੋਕ ਪਸੰਦ ਹੀ ਕਿ ਥੋੜ੍ਹੀ ਜਿਹੀ ਖੜਵੀਂ ਕਰਦੇ ਵੀ ਥੋੜ੍ਹੀ ਜਿਹੀ ਕੱਚੀ ਹੋਣੀ ਚਾਹੀਦੀ ਹੈ ਗੋਭੀ ਉਹ ਨਾ ਤਾਂ ਨਹੀਂ ਦੁੱਧ ਪਾਉਂਦੇ ਹੈਗੇ ਕਈ ਵਾਰੀ ਨਾ ਗੈਸ ਤੇਜ਼ਾਬ ਕਹਿੰਦੇ ਬਈ ਬਣ ਜਾਂਦਾ ਦੁੱਧ ਪਾਲ ਕੇ ਰਾਤ ਨੂੰ ਸਬਜ਼ੀ 'ਚ ਤਾਂ ਨਹੀਂ ਅਸੀਂ ਪਾਇਆ ਗਾਜਰਾਂ ਮਟਰਾਂ 'ਚ ਦੁੱਧ ਨਹੀਂ ਨਹੀਂ ਫਿਰ ਕੱਲ ਵੇਖੀ ਨਾ ਅਸੀਂ ਚਲੋ ਪਾ ਦਿਆ ਕਰਾਂਗੇ ਅਗਾਂਹ ਵਾਸਤੇ ਅਤੇ ਜੇ ਤੁਹਾਡੀ ਨਹੀਂ ਅੱਛਾ ਹਾਂ ਨਹੀਂ ਅਸੀਂ ਆਪਦੇ ਜਣੇ ਤਾਂ ਵਧੀਆ ਹੀ ਬਣਾਉਣੇ ਆ ਤੇ ਚਲੋ ਅਗਾਂਹ ਵਾਸਤੇ ਆਪਾਂ ਬਦਲ ਦਿੰਦੇ ਹਾਂ ਕੋਈ ਹੋਰ ਸਿਸਟਮ ਚਲਾ ਲੈਂਦੇ ਆ ਬਈ ਉਵੇਂ ਬਣਾ ਲਿਆ ਕਰਾਂਗੇ ਪਰ ਬਣਾਉਣੇ ਤਾਂ ਅਸੀਂ ਬਹੁਤ ਵਧੀਆ ਸਾਡੇ ਤਾਂ ਉਥੇ ਬਹੁਤ ਵਧੀਆ ਚੀਜ਼ ਬਣਦੀ ਆ ਅੱਛਾ ਅਤੇ ਖੀਰ

ਅਤੇ ਕਸਟਡ ਪਾਈਏ ਕਿ ਨਾ ਪਾਈਏ ਦੁੱਧ ਜਿਵੇਂ ਕਿ ਨਾ ਅੱਛਾ ਜਿਵੇਂ ਕਹੋ ਕਿ ਉਵੇਂ ਹੀ ਬਣਾ ਦਿਆਂਗੇ ਅਸੀਂ ਤਾਂ ਅੱਜ ਅਸੀਂ ਸਬਜ਼ੀ ਇੱਕ ਤਾਂ ਮਟਰ ਪਨੀਰ ਆ ਅਤੇ ਇੱਕ ਕੜ੍ਹੀ ਪਕੌੜੇ ਆ ਆਲੂ ਪਾਲਕ ਆ ਇਕ ਇਕ ਮੂੰਗੀ ਦੀ ਦਾਲ ਆ ਸਾਬਤ ਦੀ ਠੀਕ ਆ ਬਣਾ ਦਿਆਂਗੇ ਠੀਕ ਆ